ਪੰਜਾਬ ਵਿੱਚ ਟੈਕਨੋਲੋਜੀ ਸੈਕਟਰ ਸਿਖਰ ਦੀ ਪ੍ਰਤਿਭਾ ਜਾਂ ਹੁਨਰ ਨੂੰ ਬਰਕਰਾਰ ਰੱਖਦਾ ਹੈ ਯਾ ਅਕਰਸ਼ਿਤ ਕਰਦਾ ਹੈ ਅੱਜ ਟੈਕਨੋਲੋਜੀ ਹਰ ਸੈਕਟਰ ਵਿੱਚ ਬਹੁਤ ਜਰੂਰੀ ਹੋ ਚੁੱਕੀ ਹੈ ਪਰ ਸੈਕ ਟੈਕਨੋਲੋਜੀ ਵਿੱਚ ਹੁਨਰ ਇਹ ਆਪਾਂ ਨੂੰ ਪ੍ਰਤਿਭਾਸ਼ਾਲੀ ਹੀ ਜਿਹੜਾ ਇਮਪਲੋਈ ਹੈਗਾ ਉਹ ਕਰ ਸਕਦਾ ਹੈ ਕਹਿੰਦੇ ਪੰਜਾਬ ਵਿੱਚ ਟੈਕਨੋਲੋਜੀ ਸੈਕਟਰ ਤਾਂ ਹਰ ਕੋਈ ਇਹੋ ਜਿਹਾ ਸੈਕਟਰ ਨਹੀਂ ਹੈਗਾ ਕੋਈ ਇਹੋ ਜਿਹਾ ਡਿਪਾਰਟਮੈਂਟ ਨਹੀਂ ਹੈਗਾ ਜਿੱਥੇ ਆਪਾਂ ਟੈਕਨੋਲੋਜੀ ਯੂਜ ਨਾ ਕਰਦੇ ਹੋਏ ਦੇਖਿਆ ਜਾਏ ਤਾਂ ਹਰ ਸੈਕਟਰ ਹੀ ਆਨਲਾਈਨ ਹੋ ਚੁੱਕਿਆ ਕਹਿੰਦੇ ਪਰ ਕਹਿੰਦੇ ਇਹ ਦੀ ਇੱਕ ਸਪੈਸ਼ਲ ਸਿਖਲਾਈ ਹੁੰਦੀ ਹ ਜਿਹਦੇ ਆਧਾਰ ਤੇ ਉਹ ਵਧੀਆ ਤੋਂ ਵਧੀਆ ਕੰਮ ਕਰਦੇ ਹਨ ਤੇ ਅਪੋਆਇੰਟਮੈਂਟ ਵੀ ਉਹਨਾਂ ਦੀ ਹੋਈ ਹੁੰਦੀ ਹੈ ਜਿਨਾਂ ਦੀ ਸਿਖਲਾਈ ਆ ਜਿਨਾਂ ਦੀ ਟ੍ਰੇਨਿੰਗ ਸਭ ਤੋਂ ਵੱਧ ਹੁੰਦੀ ਹੈ ਕਿਉਂਕਿ ਇਸ ਟੈਕਨੋਲੋਜੀ ਖੇਤਰ ਵਿੱਚ ਆਪਾਂ ਜਿੰਨਾ ਕਹਿ ਸਕੀਏ ਵੀ ਜਿੰਨੀ ਆਪਾਂ ਟ੍ਰੇਨਿੰਗ ਜਾਂ ਜਿੰਨਾ ਆਪਾਂ ਸਿੱਖਦੇ ਆਂ ਵੀ ਉਦਾ ਹੀ ਮੁੱਲ ਪੈਂਦਾ ਤੇ ਕਹਿੰਦੇ ਇਸੇ ਆਧਾਰ ਤੇ ਹੀ ਇਸੇ ਹੁਨਰ ਦੇ ਆਧਾਰ ਤੇ ਹੀ ਕੀ ਹੈਗਾ ਵੀ ਉਹ ਆਪਣੇ ਟੈਕਨੋਲੋਜੀ ਨੂੰ ਬਰਕਰਾਰ ਰੱਖ ਪਾਂਦਾ ਹੈ ਤੇ ਟੈਕਨੋਲੋਜੀ ਦੇ ਆਧਾਰ ਤੇ ਹੀ ਇੱਕ ਇਮਪਲੋਈ ਆਫ ਦ ਈਅਰ ਵੀ ਕੱਢਿਆ ਜਾਂਦਾ ਜਿਹਦੇ ਆਧਾਰ ਤੇ ਬੈਸਟ ਇਮਪਲੋਈ ਨੂੰ ਚੂਜ ਕੀਤਾ ਜਾਂਦਾ ਹੈ ਟੈਕਨੋਲੋਜੀ ਦੇ ਅਧਾਰ ਤੇ ਹੀ ਹਰ ਕਿਸੀ ਇਮਪਲੋਈ ਦੀ ਯਾ ਕਹਿ ਲਓ ਵੀ ਕੰਪੀਟੀਟਿਵ ਇਗਜਾਮ 'ਚ ਵੀ ਉਹੀ ਇਮਪਲੋਈ ਜਿਹੜਾ ਹੈਗਾ ਉਹ ਅਪੁਆਇੰਟ ਹੁੰਦਾ ਜਿਹਦੀ ਟੈਕਨੋਲੋਜੀ ਵਿੱਚ ਉਹਨੂੰ ਜਿਆਦਾ ਹੁਨਰ ਜਾਂ ਉਹਨੂੰ ਸਿਖਲਾਈ ਆ ਟ੍ਰੇਨਿੰਗ ਦਿੱਤੀ ਗਈ ਹੈ ਕਹਿੰਦੇ ਟੈਕਨੋਲਜੀ ਦੇ ਆਧਾਰ ਤੇ ਹੀ ਆਪਾਂ ਕਈ ਤਰਾਂ ਦੀਆਂ ਇਹੋ ਜਹੀਆਂ ਜੋਬਸ ਹਾਸਿਲ ਕਰਦੇ ਆ ਜੋ ਸਿਰਫ ਸਾਡੇ ਹੁਨਰ ਦੀ ਬੇਜਤੀ ਹੁੰਦੀ ਹੈ ਵੀ ਇਹਦੇ ਵਿੱਚ ਕੋਈ ਪਰਸੈਂਟੇਜ ਕੋਈ ਮਾਰਕਸ ਕੁਛ ਮਾਇਨੇ ਨਹੀਂ ਰੱਖਦੇ ਇਹਦੇ ਵਿੱਚ ਸਿਰਫ ਟੈਕਨੋਲੋਜੀ ਵਿੱਚ ਉਹਦੀ ਕੀ ਪ੍ਰਤਿਭਾ ਹੈ ਉਹਦਾ ਕੀ ਹੁਨਰ ਹੈ ਜਿਹਦੇ ਆਧਾਰ ਤੇ ਉਹ ਕੰਮ ਨੂੰ ਭਲੀਭਾਂਤ ਪੂਰੀ ਕਰ ਸਕਦਾ ਹੈ ਟੈਕਨੋਲੋਜੀ ਇੱਕ ਇਹੋ ਜਿਹਾ ਸੈਕਟਰ ਹੈਗਾ

ਇਸ ਕਰਕੇ ਕਹਿੰਦੇ ਵੀ ਇਹਦੀ ਪੂਰੀ ਤਰ੍ਹਾਂ ਨਾਲ ਇਹਨੂੰ ਇਹਦੀ ਸਿਖਲਾਈ ਦਿੱਤੀ ਜਾਂਦੀ ਹੈ ਜਦੋਂ ਆਪਾਂ ਜੋ ਵੀ ਸਟਡੀ ਕਰਦੇ ਆਂ ਜਦੋਂ ਆਪਣਾ ਏਮ ਹੁੰਦਾ ਵੀ ਆਪਾਂ ਐਜ ਟੈਕਨੀਸ਼ੀਅਨ ਬਣਨਾ ਜਾਂ ਐ ਆ ਆਪਾਂ ਮਕਾਨੀਕਲੀ ਇੰਜੀਨੀਅਰ 'ਚ ਜਾਨਾ ਤੇ ਆਪਾਂ ਨੂੰ ਉਸ ਅਧਾਰ ਤੇ ਹੀ ਉਹਦੀ ਪੂਰੀ ਤਰ੍ਹਾਂ ਨਾਲ ਸਿਖਲਾਈ ਦਿੱਤੀ ਜਾਂਦੀ ਹੈ ਤਾਂ ਕੀ ਆਪਾਂ ਜੋ ਵੀ ਕੰਪੀਟੀਟਿਵ ਐਗਜ਼ਾਮ ਹੈਗੇ ਜੋ ਵੀ ਆਪਾਂ ਜੋਬਸ ਆਫਰ ਕੀਤੀਆਂ ਜਾਂਦੀਆਂ ਉਹ ਸਿਰਫ ਸਾਡੇ ਟੈਲੈਂਟ ਦੇ ਆਧਾਰ ਤੇ ਹੀ ਸਾਨੂੰ ਅਪੋਆਇੰਟਮੈਂਟ ਦਿੱਤੀ ਜਾਂਦੀ ਹੈ ਤੇ ਜਿਨਾਂ ਹੁਨਰ ਜਾਂ ਐਕਸਪੀਰੀਅਂਸ ਜਾਂ ਪ੍ਰਤਿਭਾ ਤੁਹਾਡੇ ਕੋਲ ਵੱਧ ਹੋਏਗੀ ਉਨੀ ਹੀ ਤੁਹਾਡੀ ਸੈਲਰੀ ਵਿੱਚ ਵੀ ਬਹੁਤ ਜਿਆਦਾ ਫਰਕ ਪੈਂਦਾ ਤੋ ਇਸ ਕਰਕੇ ਪੰਜਾਬ ਵਿੱਚ ਟੈਕਨੋਲੋਜੀ ਦੇ ਮਤਲਬ ਕਿ ਹਰ ਖੇਤਰ ਵਿੱਚ ਆ ਚੁੱਕੀ ਹੈ ਟੈਕਨੋਲੋਜੀ ਤੋਂ ਬਿਨਾਂ ਕੋਈ ਵੀ ਖੇਤਰ ਜਿਹੜਾ ਉਹ ਝੂਠਾ ਨਹੀਂ ਹੈਗਾ ਇਸ ਕਰਕੇ ਆਪਾਂ ਹਰ ਟੈਕਨੋਲੋਜੀ ਮਤਲਬ ਜਿੰਨੀ ਵੀ ਟੈਕਨੋਲੋਜੀ ਕਹਿ ਲਓ ਵੀ ਉਹ ਚਾਹੇ ਜਿਸ ਤਰ੍ਹਾਂ ਦੀ ਵੀ ਆ ਉਹਦੇ ਵਿੱਚ ਪ੍ਰਤਿਭਾ ਯਾਂ ਹੁਨਰ ਹੋਣਾ ਜਾਂ ਉਹਦੀ ਪ੍ਰੋਪਰ ਸਿਖਲਾਈ ਹੋਣੀ ਬਹੁਤ ਜਿਆਦਾ ਜਰੂਰੀ ਹ ਇਸ ਕਰਕੇ ਕਹਿੰਦੇ ਕਈ ਕੰਪਟੀਟਿਵ ਇਗਜ਼ਾਮਸ ਵੀ ਆਪਾਂ ਜਿਹੜੀ ਭਰਤੀ ਹ ਜੋਬਸ ਦੀ ਵੈਕੈਂਸੀਜ ਦੀ ਜਿਹੜੀ ਵੀ ਭਰਤੀ ਹ ਉਹ ਵੀ ਕੋਪੀਟੀਟਿਵ ਇਗਜ਼ਾਮ ਜਾਂ ਉਸ ਇਮਪਲੋਈ ਦੀ ਹੁਨਰ ਤੇ ਯਾਂ ਪ੍ਰਤਿਭਾ ਤੇ ਡਿਪੈਂਡ ਕਰਦੀ ਹੈ